ਜੇਕਰ ਸਾਡੇ ਇਲਾਕੇ ਵਿੱਚ ਰੁੱਖ ਲਗਾਉਣ ਦੇ ਉਪਰਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੀਆਂ ਐਨਜੀਓ ਸਰਕਾਰ ਅਤੇ ਲੋਕ ਰੁੱਖ ਲਗਾਉਣ ਲਈ ਕੋਸ਼ਿਸ਼ਾਂ ਕਰਦੇ ਹਨ ਅਤੇ ਰੁੱਖ ਲਗਾਉਂਦੇ ਹਨ ਜਿਵੇਂ ਕਿ ਸੰਤ ਸੀਚੇਵਾਲ ਬਾਬਾ ਸੇਵਾ ਸਿੰਘ ਇਕੋ ਸਿੱਖ ਰਾਉਂਡਗਿਲਾਸ ਫਾਊਂਡੇਸ਼ਨ ਇਹ ਸਾਰੀਆਂ ਸੰਸਥਾਵਾਂ ਮੁਫਤ ਵਿੱਚ ਲੋਕਾਂ ਨੂੰ ਰੁੱਖ ਦਿੰਦੀਆਂ ਹਨ ਅਤੇ ਰੁੱਖ ਲਗਵਾਉਂਦੀਆਂ ਹਨ ਨੰਨ੍ਹੀ ਛਾਂ ਇਹ ਸਾਰੀਆਂ ਸੰਸਥਾਵਾਂ ਰਾਹੀਂ ਜਿਹੜੇ ਰੁੱਖ ਆ ਉਹ ਲਗਵਾਏ ਜਾਂਦੇ ਹੈ ਇਸ ਦੇ ਨਾਲ ਹੀ ਸਰਕਾਰ ਸੜਕਾਂ ਦੇ ਕਿਨਾਰਿਆਂ 'ਤੇ ਰੁੱਖ ਲਗਾਉਂਦੀ ਹੈ ਜੇਕਰ ਆਪਾਂ ਰੁੱਖਾਂ ਦੀ ਕਟਾਈ ਬਾਰੇ ਸੋਚਦੇ ਹਾਂ ਤਾਂ ਸਮਾਂ ਜਿਹੜਾ ਉਸਦੇ ਵਿਕਾਸ ਦੇ ਹੋਣ ਨਾਲ ਰੁੱਖ ਜਿਹੜੇ ਕੱਟੇ ਜਾ ਰਹੇ ਹੈ ਵੱਡੀਆਂ ਵੱਡੀਆਂ ਸੜਕਾਂ ਬਣ ਰਹੀਆਂ ਹਨ ਫੈਕਟਰੀਆਂ ਲੱਗ ਰਹੀਆਂ ਹਨ ਸੜਕਾਂ ਚੌੜੀਆਂ ਹੋ ਰਹੀਆਂ ਨੇ ਜਿਸ ਨਾਲ ਕਿ ਰੁੱਖਾਂ ਦਾ ਨੁਕਸਾਨ ਹੋ ਰਿਹਾ ਇਸ ਦੀ ਭਰਭਾਈ ਲਈ ਸਭ ਤੋਂ ਪਹਿਲਾਂ ਸਰਕਾਰ ਨੂੰ ਚਾਹੀਦਾ ਕਿ ਜਿੰਨੇ ਵੀ ਰੁੱਖ ਕੱਟੇ ਜਾਂਦੇ ਹਨ ਉਸ ਤੋਂ ਦੁੱਗਣੀ ਜਾ ਤਿੱਗਣੀ ਮਾਤਰਾ ਵਿੱਚ ਰੁੱਖ ਲਗਾਏ ਜਾਣ ਇਸਦੇ ਨਾਲ ਰੁੱਖ ਲਗਾਉਣਾ ਹੀ ਕਾਫ਼ੀ ਨਹੀਂ ਉਹਨਾਂ ਦੀ ਸਾਂਭ ਸੰਭਾਲ ਜ਼ਰੂਰੀ ਬਣਾਈ ਜਾਵੇ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਕਿ ਅੱਜ ਕੱਲ੍ਹ ਰੁੱਖ ਲੱਗ ਤਾਂ ਬਹੁਤ ਰਹੇ ਹਨ ਪਰ ਉਹਨਾਂ ਦੀ ਸਾਂਭ ਸੰਭਾਲ ਨਹੀਂ ਹੋ ਰਹੀ ਕਿਉਂਕਿ ਸਾਂਭ ਸੰਭਾਲ ਬਿਨਾਂ ਰੁੱਖ ਕਾਮਯਾਬ ਨਹੀਂ ਹੁੰਦੇ ਇਸ ਲਈ ਇਕੱਲੇ ਰੁੱਖ ਲਗਾਉਣ ਨਾਲ ਨਹੀਂ ਉਹਨਾਂ ਦੀ ਸਾਂਭ ਸੰਭਾਲ ਕਰਨ ਨਾਲ ਹੀ ਜਿਹੜਾ ਵਾਤਾਵਰਨ ਹੈ ਉਹ ਸਾਫ ਰਹਿ ਸਕਦਾ